ਮੇਰੀ ਜ਼ਿੰਦਗੀ ਦੀ ਸਭ ਤੋਂ ਸੁੰਦਰ ਯਾਤਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੀ ਇਹ ਯਾਤਰਾ ਮੇਰੇ ਲਈ ਬਹੁਤ ਹੀ ਖਾਸ ਸੀ ਇਸ ਯਾਤਰਾ ਵਿੱਚ ਮੈਂ ਬਹੁਤ ਅਨੁਭਵ ਪਾਇਆ ਇਸ ਯਾਤਰਾ ਵਿੱਚ ਸਾਨੂੰ ਇੱਕ ਹਫਤੇ ਦਾ ਟਾਈਮ ਲੱਗਿਆ ਜਿਸ ਵਿੱਚ ਪਹਾੜਾਂ 'ਤੇ ਚੜ੍ਹਨਾ ਬਰਫੀਲਾ ਥਾਂ ਦੇਖਣੀ ਅਤੇ ਹੋਰ ਕਈ ਤਰ੍ਹਾ ਦੀਆਂ ਚੀਜ਼ਾਂ ਦੇਖੀਆਂ ਜੋ ਕਿ ਬਹੁਤ ਵਧੀਆ ਵਾਪਸੀ